ਹੈਲੋ ਹੈਲੋ ਹਾਂਜੀ ਸਰ ਤੁਸੀਂ ਖੁਸ਼ਦੇਵ ਫਰਨੀਚਰ ਤੋਂ ਬੋਲਦੇ ਹੋ ਅਰਨੀਵਾਲਾ ਤੋਂ ਅੱਛਾ ਮੈਂ ਨਾ ਇੱਕ ਬੈਡ ਬਨਵਾਣਾ ਸੀ ਆਪਦੇ ਰੂਮ ਲਈ ਨਹੀਂ ਮੈਂ ਐਕਚੁਲੀ ਸਾਈਜ਼ ਦੇ ਅਕੋਰਡਿੰਗ ਬਣਵਾਉਣਾ ਸੀਗਾ ਰੂਮ ਦੇ ਹਾਂਜੀ

ਹਾਂਜੀ ਹਾਂਜੀ ਵੂਡਨ ਮਟੀਰੀਅਲ ਕਿੱਦਾਂ ਦਾ ਹੁੰਦਾ ਮਤਲਬ ਕਿਹੜਾ ਯੂਜ ਕਰਦੇ ਹੋ ਤੁਸੀਂ ਅੱਛਾ ਅੱਛਾ ਠੀਕ ਹੈ ਜੀ ਫਿਰ ਰੇਟ ਮਤਲਬ ਤੁਹਾਡੇ ਕਿਥੋਂ ਸਟਾਰਟ ਹੁੰਦੇ ਆ ਕਿੰਨੇ ਤੋਂ ਹਾਂਜੀ ਹਾਂਜੀ ਚੋਇਸ ਤਾਂ ਬਾਕਸ ਵਾਲਾ ਹੀ ਚਾਹੀਦਾ ਬਾਕਸ ਵਾਲਾ ਬੈਡ ਹੀ ਚਾਹੀਦਾ ਨਹੀਂ ਨਹੀਂ ਨੋਰਮਲ ਲੱਕੜ ਵਾਲਾ ਹੀ ਚਾਹੀਦਾ ਡਰੋਰ ਵਗੈਰਾ ਵੀ ਜਿਆਦਾ ਨਹੀਂ ਮਤਲਬ ਸਿੰਪਲ ਸੋਬਰ ਬਣਵਾਉਣਾ ਆ ਹਾਂਜੀ ਹੋਵੇ ਪਰ ਜਿਆਦਾ ਨਹੀਂ ਮਤਲਬ ਜਿਵੇਂ ਇੱਕ ਡਰੋਰ ਇੱਕ ਸਾਈਡ ਤੇ ਜਿਵੇਂ ਇੱਕ ਸਾਈਡ ਤੇ ਹੋ ਗਿਆ ਦੂਜੀ ਸਾਈਡ ਤੇ ਹੋ ਗਿਆ ਇੱਕ ਹਾਂਜੀ ਹਾਂਜੀ ਉਹ ਬਣਵਾਉਣੀ ਹੈ ਬਟ ਸਿੰਪਲ ਜਿਹੀ ਹੀ ਬਣਵਾਉਣੀ ਆ ਵੀ ਤੁਸੀਂ ਮੈਨੂੰ ਇਹ ਦੱਸੋ ਹਾਂਜੀ ਟੈਨ ਬਾਏ ਟੈਨ ਹੈ ਹਾਂਜੀ ਹਾਂਜੀ ਜਿਆਦਾ ਊਂਚਾ ਹੋਣਾ ਨੀ ਚਾਹੀਦਾ ਪਾਵਿਆਂ ਲਈ ਹੋਵੇ ਤੇ ਜਿਆਦਾ ਉੱਚਾ ਨਹੀਂ ਕਿਵੇਂ ਕਿਵੇਂ ਹਾਂਜੀ ਹਾਂਜੀ ਜਾਂ ਫਿਰ ਤੁਸੀਂ ਜਾਂ ਫਿਰ ਤੁਸੀਂ ਇੱਕ ਵਾਰੀ ਇਹ ਪਹਿਲਾਂ ਮੈਂ ਆ ਜੂ ਮੈਂ ਦੇਖ ਜੁੰ ਬੈਡ ਵੀ ਬਣੇ ਹੋਏ ਤੇ ਜਾਂ ਫਿਰ ਤੁਸੀਂ ਆ ਜੀਓ ਤੁਸੀਂ ਸਾਈਜ਼ ਦੇ ਅਕੋਰਡਿੰਗ ਬਣਾ ਦਿਓ ਤੁਸੀਂ ਹਾਂਜੀ ਕੋਈ ਨਾ ਮੈਂ ਤੁਹਾਨੂੰ ਨਾ ਕੋਈ ਗੂਗਲ ਤੋਂ ਜਿਵੇਂ ਫੋਟੋਜ਼ ਵਗੈਰਾ ਕੁਛ ਕੁਛ ਸਲੈਕਟ ਕਰਕੇ ਭੇਜ ਦੋ ਜਿੱਦਾਂ ਦਾ ਫਿਰ ਤੁਹਾਨੂੰ ਸਹੀ ਲੱਗਿਆ ਮੈਨੂੰ ਇਹ ਦੱਸ ਦਿਓ ਨਾ ਨਾਲੇ ਜਿਆਦਾ ਹਾਂਜੀ ਹਾਂਜੀ ਕੋਈ ਨਾ ਤੁਸੀਂ ਫਾਜਿਲਕਾ ਆ ਜਿਓ ਗੁਰੂ ਨਾਨਕ ਨਗਰੀ ਚ ਅੱਗੋ ਹਾਂਜੀ ਗੁਰੂ ਨਾਨਕ ਗਲੀ ਨੰਬਰ ਫਾਈਵ ਤੇ ਤੁਸੀਂ ਆ ਕੇ ਲੈ ਜਾਓ ਮਤਲਬ ਦੇਖ ਸਕਦੇ ਹੋ ਕਾਲ ਕਰ ਲਿਓ ਹਾਂਜੀ ਠੀਕ ਹੈ ਜੀ ਥੈੰਕਯੂ ਜੀ